ਕੋਵਿਡ ਨਾਈਨਟੀਨ ਪਹਿਲਾਂ ਤਾਂ ਸਭ ਨੂੰ ਆਮ ਜਿਹੀ ਬਿਮਾਰੀ ਹੀ ਲੱਗਦੀ ਸੀਗੀ ਕਿ ਆਮ ਜਿਹਾ ਹੀ ਜੁਕਾਮ ਆ ਖਾਂਸੀ ਅਤੇ ਆਮ ਹੀ ਹੋ ਜਾਂਦਾ ਹੈ ਅਤੇ ਪਰ ਜਦੋਂ ਇਸਦੇ ਕੇਸ ਬਹੁਤ ਜ਼ਿਆਦਾ ਵ ਵਧਣ ਲੱਗੇ ਤਾਂ ਇਸ ਦਾ ਇਲਾਜ ਵੀ ਕੋਈ ਨਾ ਹੋਣ ਕਰਕੇ ਡੋਕਟਰ ਨੇ ਸਲਾਹ ਦਿੱਤੀ ਕਿ ਇਹ ਬਿਮਾਰੀ ਇੱਕ ਦੂਜੇ ਦੇ ਮਿਲਣ ਨਾਲ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਜ਼ਿਆਦਾ ਫੈਲਦੀ ਹੈ ਤਾਂ ਫਿਰ ਡੋਕਟਰਾਂ ਨੇ ਇਸਦਾ ਹੱਲ ਇਹ ਕੱਢਿਆ ਕਿ ਇੱਕ ਸਾਨੂੰ ਇੱਕ ਦੂਸਰੇ ਨੂੰ ਨਹੀਂ ਮਿਲਣਾ ਚਾਹੀਦਾ ਅਤੇ ਮੂੰਹ 'ਤੇ ਮਾਸਕ ਵਗੈਰਾ ਪਾ ਕੇ ਰੱਖਣੇ ਚਾਹੀਦੇ ਸਨ ਅਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਅਨਾਊਂਸ ਕੀਤਾ ਕਿ ਸਾਨੂੰ ਇੱਕ ਦਿਨ ਲਈ ਆਪਣੇ ਹੀ ਘਰ ਦੇ ਅੰਦਰ ਹੀ ਬੰਦ ਹੋਣਾ ਪਵੇਗਾ ਅਤੇ ਸਾਰਿਆਂ ਨੇ ਇੱਦਾਂ ਹੀ ਕੀਤਾ ਇੱਕ ਦਿਨ ਲਈ ਸਾਰਾ ਕੁਛ ਹੀ ਬੰਦ ਕਰਤਾ ਆਪਣੀਆਂ ਦੁਕਾਨਾਂ ਬੰਦ ਕਰਤੀਆਂ ਆਪਣੇ ਆਪ ਹੀ ਘਰ ਨੂੰ ਘਰ ਵਿੱਚ ਬੰਦ ਕਰ ਲਿਆ ਅਤੇ ਫਿਰ ਵੀ ਇਹ ਮਾਮਲਿਆਂ ਵਿੱਚ ਕੋਈ ਫਰਕ ਨਹੀਂ ਪਿਆ ਕੋਵਿਡ ਦੇ ਮਾਮਲੇ ਹੋਰ ਵੱਧਦੇ ਅਤੇ ਵੱਧਦੇ ਜਾ ਰਹੇ ਸੀ ਫਿਰ ਇਸ ਨੂੰ ਲੋਕਡਾਊਨ ਨੂੰ ਹੋਰ ਅੱਗੇ ਵਧਾਉਣਾ ਪਿਆ ਅਤੇ ਇਹ ਲੋਕਡਾਊਨ ਪੂਰਾ ਦਸ ਪੰਦਰਾਂ ਦਿਨ ਚੱਲਿਆ ਇਹਨਾਂ ਦਸ ਪੰਦਰਾਂ ਦਿਨ ਵਿੱਚ ਸਾਰੀਆਂ ਹੀ ਦੁਕਾਨਾਂ ਬੰਦ ਸੀਗੀਆਂ ਸਿਰਫ ਹੀ ਜ਼ਰੂਰੀ ਸਮਾਨ ਦੀਆਂ ਵਸਤੂਆਂ ਜਿਹਨਾਂ ਨਾਲ ਲੋਕ ਜਿਉਂਦੇ ਰਹਿ ਸਕਣ ਉਹੀ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਸੀਗੀਆਂ ਚਾਲੂ ਸੀਗੀਆਂ ਜਿੱਦਾਂ ਕਿ ਮੈਡੀਕਲ ਦੀਆਂ ਸੁਵਿਧਾਵਾਂ ਸੀਗੀਆਂ ਦੁੱਧ ਡੇਅਰੀ ਸੀਗੀਆਂ ਦਵਾਈਆਂ ਦੀਆਂ ਸੁਵਿਧਾਵਾਂ ਸੀਗੀਆਂ ਪੈਟਰੋਲ ਪੰਪ ਸੀਗੇ ਜਾਂ ਕੁਛ ਸਾਡੇ ਜਿਹੜੇ ਸਿਵਿਲ ਸਰਵਿਸ ਦੇ ਹੈਗੇ ਸੀਗੇ ਪੁਲਿਸ ਵਗੈਰਾ ਸੀਗੀ ਉਹਨਾਂ ਨੂੰ ਹੀ ਸਿਰਫ ਇੱਧਰ ਉੱਧਰ ਜਾਣ ਦੀ ਇਜਾਜ਼ਤ ਹੁੰਦੀ ਸੀਗੀ ਉਹ ਵੀ ਜਿਨ੍ਹਾਂ ਕੋਲ ਸਰਕਾਰ ਦਾ ਬਣਿਆ ਹੋਇਆ ਇੱਕ ਪਾਸ ਹੁੰਦਾ ਸੀਗਾ ਸੋਸ਼ਲ ਸਰਵੈਂਟ ਦਾ ਉਹੀ ਇੱਧਰ ਉੱਧਰ ਜਾ ਸਕਦੇ ਸੀਗੇ ਕੋਵਿਡ ਨਾਈਨਟੀਨ ਦੇ ਦੌਰਾਨ ਅਤੇ ਬਾਕੀ ਸਾਰਿਆਂ ਬੰਦ ਹੁੰਦਾ ਸੀਗਾ ਅਤੇ ਜ਼ਰੂਰੀ ਚੀਜ਼ਾਂ ਲੈਣ ਵਾਸਤੇ ਵੀ ਕੁਝ ਸਮਾਂ ਦਿੱਤਾ ਜਾਂਦਾ ਸੀਗਾ ਜਿਵੇਂ ਕਿ ਸ਼ਾਮ ਨੂੰ ਇੱਕ ਘੰਟਾ ਛੇ ਵਜੇ ਤੋਂ ਲੈ ਕੇ ਸੱਤ ਵਜੇ ਤੱਕ ਸਵੇਰੇ ਨੌ ਵਜੇ ਤੋਂ ਲੈ ਕੇ ਦਸ ਵਜੇ ਤੱਕ ਜਾਂ ਗਿਆਰਾਂ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਦਾ ਹੀ ਸਮਾਂ ਇੱਦਾਂ ਦ ਦਿੱਤਾ ਜਾਂਦਾ ਸੀਗਾ ਜਿਹਦੇ ਵਿੱਚ ਕਿ ਅਸੀਂ ਆਪਣੀ ਜ਼ਰੂਰੀ ਵਸਤਾਂ ਲੈ ਸਕਦੇ ਸੀਗੇ ਹਾਂ ਪਰ ਉਹਨਾਂ ਵਿੱਚ ਵੀ ਬੜੀਆਂ ਸਾਰੀਆਂ ਪਾਬੰਦੀਆਂ ਸੀਗੀਆਂ ਜਿਵੇਂ ਕਿ ਤੁਸੀਂ ਇੱਕ ਦੂਜੇ ਤੋਂ ਇੱਕ ਦੋ ਫੁੱਟ ਦੀ ਦੂਰੀ 'ਤੇ ਰਹਿਣਾ ਵਾਂ ਮੂੰਹ 'ਤੇ ਮਾਸਕ ਪਾ ਕੇ ਬਾਹਰ ਨਿਕਲਣਾ ਵਾਂ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ ਤਾਂ ਜੋ ਇਹ ਚੇਨ ਨੂੰ ਬ੍ਰੇਕ ਕੀਤਾ ਜਾ ਸਕੇ ਅਤੇ ਫਿਰ ਹੌਲੀ ਹੌਲੀ ਸਮਾਂ ਲੰਘਿਆ ਤਾਂ ਇਹ ਚੇਨ ਹੌਲੀ ਹੌਲੀ ਬ੍ਰੇਕ ਹੋਈ ਹੈ ਅਤੇ ਫਿਰ ਕੋਵਿਡ ਦੀਆਂ ਥੋੜ੍ਹੀਆਂ ਬਹੁਤੀਆਂ ਵੈਕਸੀਨ ਵਗੈਰਾ ਵੀ ਆ ਗਈਆਂ ਅਤੇ ਫਿਰ ਇਹ ਲੋਕਡਾਊਨ ਹੌਲੀ ਹੌਲੀ ਕਰਕੇ ਖੋਲ੍ਹਿਆ ਗਿਆ